ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਇੱਥੇ ਫਰੀਦਕੋਟ ਘੁੰਮਣ ਆਈ ਹਾਂ ਤਾਂ ਮੈਂ ਕੁਝ ਤੁਹਾਡੇ ਤੋਂ ਇਨਫੋਰਮੇਸ਼ਨ ਜੀ ਲੈਣੀ ਸੀਗੀ ਕਿ ਫਰੀਦਕੋਟ ਵਿੱਚ ਕੀ ਕੁਛ ਹੈ ਵਧੀਆ ਵੇਖਣ ਨੂੰ ਰਹਿਣ ਨੂੰ ਹਾਂ ਹਾਂਜੀ ਨਹੀਂ ਅਸੀਂ ਹਾਲੇ ਰੇਲਵੇ ਸਟੇਸ਼ਨ 'ਤੇ ਹਾਂ ਅੱਛਾ ਅੱਛਾ ਸ਼ਾਹੀ ਹਵੇਲੀ ਵਧੀਆ ਰਹਿਣ ਨੂੰ ਉੱਥੇ ਅੱਛਾ ਅੱਛਾ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਅਤੇ ਇੱਕ ਹਾਂ ਇੱਥੇ ਮੈਂ ਇੱਕ ਰਾਜੇ ਦਾ ਕਿਲ੍ਹਾ ਵੀ ਸੁਣਿਆ ਸੀਗਾ ਕਿ ਕਹਿੰਦੇ ਉਹ ਵੀ ਹੈਗਾ ਫਰੀਦਕੋਟ 'ਤੇ ਰਾਜੇ ਦਾ ਕਿਲ੍ਹਾ ਅੱਛਾ ਅੱਛਾ ਅੱਛਾ ਅੱਛਾ ਬਾਬਾ ਫਰੀਦ ਦੇ ਨੇੜੇ ਅੱਛਾ ਅਤੇ ਹਾਂਜੀ ਹਾਂਜੀ ਅੱਛਾ ਅੱਛਾ ਅਤੇ ਉਹ ਹਾਂਜੀ ਠੀਕ ਆ ਜੀ ਅਤੇ ਹਾਂਜੀ ਅਤੇ ਉਹ ਸ਼ਾਹੀ ਹਵੇਲੀ ਕਿੰਨਾ ਕੁ ਦੂਰ ਆਪਣੇ ਫਰੀਦਕੋਟ ਦੇ ਅੰਦਰ ਹੀ ਹੈ ਕਿ ਫਰੀਦਕੋਟ ਤੋਂ ਥੋੜ੍ਹਾ ਪਰ੍ਹਾ ਪੈ ਜਾਂਦਾ ਅੱਛਾ ਅੱਛਾ ਅੱਛਾ ਅੱਛਾ ਅੱਛਾ ਅੱਛਾ ਅੱਛਾ ਇੱਕ ਮੈਂ ਤਾਂ ਮੈਡੀਕਲ ਵੀ ਬੜਾ ਸੁਣਿਆ ਇੱਥੇ ਫਰੀਦਕੋਟ 'ਚ ਗੁਰੂ ਗੋਬਿੰਦ ਮੈਡੀਕਲ ਲੋਕ ਕਹਿੰਦੇ ਬੜਾ ਫੇਮਸ ਹੈ ਕਿ ਵੱਡੇ ਵੱਡੇ ਇਲਾਜ ਹੁੰਦੇ ਨੇ ਇੱਥੇ ਹੈ ਨਾ ਹਾਂ ਅੱਛਾ ਅੱਛਾ ਹਾਂਜੀ ਹਾਂਜੀ ਮੇਰੇ ਬੱਚੇ ਹੈਗੇ ਉਹ ਬੱਚੋਂ ਕੀ ਨਾਮ ਆ ਉਹਨਾਂ ਨੇ ਫਰਦਰ ਸਟਡੀ ਕਰਨੀ ਹੈਗੀ ਆ ਪਲਸ ਟੂ ਉਹਨਾਂ ਦੀ ਹੋ ਚੱਲੀ ਆ ਮੈਂ ਕਿਹਾ ਸੋਚਿਆ ਕਿ ਐਮ ਬੀ ਬੀ ਐਸ ਜਾਂ ਬੀ ਡੀ ਐਸ ਵਗੈਰਾ ਕਰਵਾ ਦੇਵਾਂਗੇ ਉਹਨਾਂ ਨੂੰ ਹਾਂਜੀ ਹਾਂਜੀ ਹਾਂਜੀ ਹਾਂਜੀ ਬੱਚੇ ਆਏ ਹੋਏ ਆ ਹਾਂਜੀ ਵਧੀਆ ਹਾਲੇ ਤਾਂ ਘੁੰਮਾਂਗੇ ਸੋਚਿਆ ਸੀਗਾ ਅਤੇ ਇਹ ਤੁਹਾਨੂੰ ਕਦੋਂ ਫਰੀ ਟਾਈਮ ਮਿਲਦਾ ਤਾਂ ਤੁਸੀਂ ਵੀ ਨਾਲ ਆ ਜਾਇਓ ਸਾਡੇ ਹਾਂਜੀ ਸਰ ਕੇਰਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਸਰ ਠੀਕ ਆ ਜੀ ਸਰ ਕੇਰਾਂ ਐ ਕਰ ਲਵਾਂਗੇ ਕਿ ਕੇਰਾਂ ਤੁਹਾਡੇ ਘਰ ਆ ਜਾਵਾਂਗੇ ਅਤੇ ਫਿਰ ਉਸ ਤੋਂ ਬਾਅਦ ਦੇਖਾਂਗੇ ਕਿ ਸਿਰਫ ਫੈਮਿਲੀ ਦੇ ਨਾਲ ਉੱਥੇ ਸ਼ਾਹੀ ਹਵੇਲੀ ਵੱਲ ਵਿਜਿਟ ਕਰ ਜਵਾਂਗੇ ਫਿਰ ਉੱਥੇ ਵੇਖ ਲਵਾਂਗੇ ਕੋਈ ਕਮਰਾ ਤੁਸੀਂ ਦੱਸ ਦਿਓ ਦਿਵਾ ਦਿਓ ਕਿਵੇਂ ਵਧੀਆ ਕਿਵੇਂ ਨਹੀਂ ਹਾਂਜੀ ਹਾਂਜੀ ਸਾਨੂੰ ਦੱਸ ਦਿਓ ਨਾ ਕਿ ਕਿਵੇਂ ਕਿੱਧਰ ਕਿੱਧਰ ਕਿਹੜੀਆਂ ਲੋਕੇਸ਼ਨਾਂ ਬਾਬਾ ਫਰੀਦ ਵੀ ਦਿਖਾ ਦਿਓ ਕਿੱਧਰ ਪੈਂਦਾ ਅਤੇ ਉਹ ਰਾਜੇ ਦਾ ਕਿਲ੍ਹਾ ਵੀ ਹਾਂਜੀ ਅੱਛਾ ਅੱਛਾ ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਜ਼ਰੂਰ ਦਿਖਾਇਓ ਜੀ ਬਸ ਅਸੀਂ ਰੇਲਵੇ ਸਟੇਸ਼ਨ ਤੋਂ ਤੁਸੀਂ ਦਸ ਕੁ ਮਿੰਟ ਬਾਅਦ ਤੁਸੀਂ ਆ ਜਾਇਓ ਸਾਨੂੰ ਰੇਲਵੇ ਸਟੇਸ਼ਨ ਤੋਂ ਰਿਸੀਵ ਕਰਨ ਆ ਜਾਇਓ ਲੈਣ ਆ ਜਾਓ ਸਾਨੂੰ ਹਾਂਜੀ ਹਾਂਜੀ ਠੀਕ ਆ ਜੀ